ਮੇਰਾ ਇੱਕ ਬਹੁਤ ਹੀ ਪਿਆਰਾ ਮਿੱਤਰ ਹੈ ਅਰਵਿੰਦ ਉਹਦੇ ਸਿਰ ਦੇ ਬਹੁਤ ਹੀ ਵਾਲ਼ ਝੜ ਰਹੇ ਸਨ ਅਤੇ ਉਹਦੇ ਸਿਰ ਵਿੱਚ ਗੰਜ ਪੈ ਚੁੱਕੀ ਸੀ ਫਿਰ ਮੈਂ ਆਪਣੇ ਦੋਸਤ ਲਈ ਆਦੀ ਵਾਸੀ ਤੇਲ ਨਾਮਕ ਇੱਕ ਤੇਲ ਮੰਗਾਇਆ ਅਤੇ ਉਹਨੂੰ ਉਹਦੇ ਵਿੱਚ ਦਿਖਾਇਆ ਜਾ ਰਿਹਾ ਸੀ ਵੀ ਇਹ ਤੇਲ ਨਾਲ਼ ਵਾਲ ਲੰਬੇ ਲੰਬੇ ਹੋ ਜਾਂਦੇ ਹਨ ਅਤੇ ਉਹਨੇ ਇਹ ਤੇਲ ਤਿੰਨ ਤੋਂ ਚਾਰ ਮਹੀਨੇ ਵਰਤਿਆ ਪਰ ਕੋਈ ਅਸਰ ਨਹੀਂ ਉਹਦੇ ਵਾਲ਼ ਲਗਾਤਾਰ ਝੜਦੇ ਰਹੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਦੀ ਵਾਸੀ ਤੇਲ ਜਮਾਂ ਹੀ ਘਟੀਆ ਬੇਕਾਰ ਹੈ ਉਸ ਨਾਲ਼ ਕੋਈ ਅਸਰ ਨਹੀਂ ਹੈ ਕੰਪਨੀ ਸਿਰਫ ਪੈਸੇ ਬਣਾ ਰਹੀ ਹੈ